ਖਾਣਾ ਬਣਾਉਣ ਵਿੱਚ ਮੇਰੀ ਮਾਂ ਬਹੁਤ ਮਦਦ ਕਰਦੀ ਹੈ ਇਸ ਵਿੱਚ ਮੇਰੀਆਂ ਭੈਣਾਂ ਵੀ ਬਹੁਤ ਮਦਦ ਕਰਦੀਆਂ ਹਨ ਅਤੇ ਮਾਂ ਸਾਨੂੰ ਇੱਕ ਤੋਂ ਇੱਕ ਡਿਸ਼ ਅਤੇ ਇੱਕ ਤੋਂ ਇੱਕ ਨਵੀਂ ਚੀਜ਼ ਬਣਾ ਕੇ ਦਿੰਦੀ ਹੈ ਜੋ ਕਿ ਸਾਡੇ ਸ਼ੌਂਕ ਜੋ ਵੀ ਅਸੀਂ ਕਹਿੰਦੇ ਹਨ ਵੀ ਆਹ ਚੀਜ਼ ਮੰਮੀ ਅੱਜ ਇਹ ਚੀਜ਼ ਬਣਾ ਦੇ ਮੰਮੀ ਅੱਜ ਇਹ ਚੀਜ਼ ਬਣਾ ਦੇ ਅਤੇ ਸਾਰੀ ਚੀਜ਼ਾਂ ਪੂਰੀਆਂ ਬਣਾਉਂਦੇ ਹਨ ਅਤੇ ਅਸੀਂ ਬੜੇ ਸ਼ੌਂਕ ਨਾਲ਼ ਉਹ ਚੀਜ਼ਾਂ ਖਾਂਦੇ ਹਨ ਅਤੇ ਅਸੀਂ ਆਪਣੀ ਮਾਂ ਦੀ ਮਦਦ ਵੀ ਕਰਦੇ ਹਨ ਅਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਚੀਜ਼ਾਂ ਬਣਾਉਣੀਆਂ ਸਿਖਾਈਆਂ ਅਤੇ ਸਾਨੂੰ ਦੱਸਿਆ ਵੀ ਹੈ ਇਸ ਵਿੱਚ ਉਹਨਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਬੜਾ ਅਹਿਮ ਰੋਲ ਰਿਹਾ ਹੈ ਇਸ ਲਈ ਸਾਨੂੰ ਕੋਈ ਵੀ ਫ਼ਿਕਰ ਕਰਨ ਦੀ ਲੋੜ ਨਹੀਂ ਪੈਂਦੀ ਸਾਨੂੰ ਸਵੇਰੇ ਉੱਠਦੇ ਸਾਰ ਰੋਟੀ ਮਿਲ ਜਾਂਦੀ ਹੈ ਅਤੇ ਚਾਹ ਮਿਲ ਜਾਂਦੀ ਹੈ ਬਿਨਾਂ ਕਹੇ ਅਤੇ ਦੁਪਹਿਰ ਦਾ ਖਾਣਾ ਵੀ ਤਿਆਰ ਹੁੰਦਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਖਾਣਾ ਤਿਆਰ ਹੁੰਦਾ ਹੈ ਜੇ ਅਸੀਂ ਕਹਿ ਦਿੱਤਾ ਕਿ ਅੱਜ ਮੰਮੀ ਸਾਨੂੰ ਕੋਈ ਮਿੱਠੀ ਚੀਜ਼ ਬਣਾ ਦੋ ਜਿਵੇਂ ਸੂਜੀ ਦਾ ਹਲਵਾ ਜਾਂ ਬੇਸਣ ਦਾ ਹਲਵਾ ਤਾਂ ਉਹ ਉਵੇਂ ਹੀ ਸ਼ੌਂਕ ਨਾਲ਼ ਬਣਾ ਕੇ ਸਾਨੂੰ ਖਲਾਉਂਦੇ ਹੈ